ਪੰਜਾਬ ਦੀ ਕਲਾ ਅਤੇ ਸ਼ਿਲਪਕਾਰੀ ਪੰਜਾਬ ਦੇ ਸੱਭਿਆਚਾਰ ਅਤੇ ਕਦਰਾਂ ਕੀਮਤਾਂ ਨੂੰ ਵਧੀਆ ਤੀ ਤਰੀਕੇ ਨਾਲ ਦਰਸਾਉਂਦੀਆਂ ਹਨ ਜਿਵੇਂ ਫੁਲਕਾਰੀ ਇਹ ਇਸ ਵਿੱਚ ਜਨਾਨੀਆਂ ਅਤੇ ਨਿੱਕੀ ਕੁੜੀਆਂ ਆਪਣੇ ਦੁਪੱਟਿਆਂ ਨੂੰ ਵਧੀਆ ਤਰੀਕੇ ਨਾਲ ਸਜਾਉਂਦੀਆਂ ਹਨ ਅਤੇ ਉਹ ਦੁਪੱਟੇ ਨੂੰ ਪਾਉਂਦੀਆਂ ਹਨ ਫ਼ੁਲਕਾਰੀ ਤੋਂ ਇਲਾਵਾ ਇਸ ਵਿੱਚ ਹੋਰ ਵੀ ਵਧੀਆ ਚੀਜ਼ਾਂ ਹੁੰਦੀਆਂ ਜਿਵੇਂ ਜੁੱਤੀ ਪੰਜਾਬੀ ਜੁੱਤੀਆਂ ਫਿਰ ਪਰਾਂਦੇ ਪਰਾਂਦੇ ਅਤੇ ਇਸ ਤੋਂ ਇਲਾਵਾ ਜੇ ਹੋਰ ਵੀ ਦੇਖਿਆ ਜਾਏ ਤਾਂ ਮਿੱਟੀ ਦਾ ਵੀ ਕੰਮ ਬੜਾ ਵਧੀਆ ਹੈ ਅਤੇ ਮਿੱਟੀ ਦੇ ਕੰਮ ਵਿੱਚ ਹੈ ਤਰ੍ਹਾਂ ਤਰ੍ਹਾਂ ਦੇ ਭਾਂਡੇ ਔਰ ਅਤੇ ਹੋਰ ਵੀ ਚੀਜ਼ਾਂ ਜਿੱਦਾਂ ਗੁੜੀਆ ਵਗੈਰਾ ਬਣਾਉਂਦੇ ਹਨ ਅਤੇ ਉਹਨਾਂ ਨੂੰ ਸਜਾਉਂਦੇ ਹਨ ਲੱਕੜਾਂ ਦਾ ਵੀ ਪੰਜਾਬ ਵਿੱਚ ਕਾਫੀ ਵਧੀਆ ਕੰਮ ਚੱਲਦਾ ਹੈ ਇਸ ਦੇ ਨਾਲ ਪੀੜੀਆਂ ਵਗੈਰਾ ਬਣਾਉਂਦੇ ਹਨ ਅਤੇ ਬੈਡ ਦੇ ਵਧੀਆ ਤੋਂ ਵਧੀਆ ਲੱਤਾਂ ਵਗੈਰਾ ਬਣਾਉਂਦੇ ਹਨ ਅਤੇ ਹੋਰ ਜੇ ਦੇਖਿਆ ਜਾਏ ਤਾਂ ਪੰਜਾਬ ਵਿਚ ਸੂਈ ਸੂਈ ਧਾਗੇ ਵਾਲਾ ਕੰਮ ਵੀ ਕਾਫੀ ਵਧੀਆ ਚਲਦਾ ਹੈ ਬੋ ਅਤੇ ਬੁਣਨ ਦਾ ਕੰਮ ਵੀ ਵਧੀਆ ਚਲਦਾ ਹੈ ਜਨਾਨੀਆਂ ਅਤੇ ਕੁੜੀਆਂ ਤਰ੍ਹਾਂ ਤਰ੍ਹਾਂ ਦੇ ਕੋਟੀਆਂ ਬੁਣਦੀਆਂ ਹਨ ਅਤੇ ਹੋਰ ਤਰ੍ਹਾਂ ਦੇ ਵਖਰੀ ਚੀਜ਼ਾਂ ਬਣਾਉਂਦੀਆਂ ਹਨ